ਹਾਂਜੀ ਮੈਂ ਬਹੁਤ ਵਾਰ ਆਪਣੇ ਹੱਥ ਨਾਲ ਕਾਰਡ ਬਣਾ ਕੇ ਆਪਣੀਆਂ ਸਹੇਲੀਆਂ ਨੂੰ ਜਨਮ ਦਿਨ 'ਤੇ ਗਿਫਟ ਕੀਤੇ ਹਨ ਇਸ ਤੋਂ ਇਲਾਵਾ ਟੀਚਰਸ ਡੇ ਵਾਲੇ ਦਿਨ ਆਪਣੇ ਅਧਿਆਪਕਾਂ ਨੂੰ ਵੀ ਜਿਹੜਾ ਇਹ ਕਾਰਡ ਬਣਾ ਕੇ ਜਿਹੜੇ ਹਨ ਉਹਨਾਂ ਨੂੰ ਗਿਫਟ ਦਿੱਤਾ ਹੈ ਅਤੇ ਇਸ ਤੋਂ ਇਲਾਵਾ ਆਪਣੇ ਘਰ ਵਿੱਚ ਵੀ ਆਪਣੇ ਹੱਥ ਦੇ ਨਾਲ ਡਰਾਇੰਗ ਕਰਕੇ ਦੀਪਾਵਲੀ ਦੇ ਮੌਕੇ 'ਤੇ ਨਵੇਂ ਸਾਲ ਦੇ ਮੌਕੇ 'ਤੇ ਅਤੇ ਲਟਕਣ ਲਗਾ ਕੇ ਉਹਨਾਂ ਨੂੰ ਅੱਛੀ ਤਰ੍ਹਾਂ ਡੈਕੋਰੇਟ ਕਰਕੇ ਜਿਹੜੇ ਕਾਫੀ ਚੀਜ਼ਾਂ ਹਨ ਉਹ ਬਣਾਈਆਂ ਹਨ ਇਸ ਕਰਕੇ ਮੈਨੂੰ ਹੱਥ ਨਾਲ ਬਣਾਈ ਹੋਈ ਜੀ ਕਲਾ ਹੈ ਉਹ ਬਹੁਤ ਪਸੰਦ ਹੈ ਕਿਉਂਕਿ ਇਹ ਬਿਲਕੁਲ ਵੱਖਰੀ ਹੁੰਦੀ ਹੈ